ਹਾਂਜੀ ਸਾਡੇ ਪਿੰਡ ਦੇ ਵਿੱਚ ਐਂਬੂਲੈਂਸ ਬਹੁਤ ਘੱਟ ਵਾਰ ਆਉਂਦੀ ਆ ਅਤੇ ਇਸ ਦੀ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਗ੍ਰਹਿਣ ਕਰਨੀ ਪੈਂਦੀ ਆ ਇਸ ਦੀ ਘੱਟ ਆਉਣ ਦੀ ਵਜਹਾ ਕਾਰਨ ਐਂਬੂਲੈਂਸ ਦੀ ਜੋ ਖ਼ਰਾਬ ਕਨੈਕਟੀਵਿਟੀ ਇਹ ਹੈ ਕਿ ਜਿੱਥੇ ਐਬੂਲੈਂਸ ਸਟੇਸ਼ਨ ਹੈ ਸਾਡੇ ਪਿੰਡ ਦੇ ਕੋਲ ਉਹ ਕਾਫ਼ੀ ਦੂਰ ਪੈ ਜਾਂਦਾ ਹੈ ਸਾਡੇ ਪਿੰਡ ਤੋਂ ਅਤੇ ਜਦੋਂ ਤੱਕ ਅਸੀਂ ਉਹਨਾਂ ਨਾਲ ਕੰਟੈਕਟ ਕਰਦੇ ਹਾਂ ਤਾਂ ਉਹਨਾਂ ਨੂੰ ਆਉਂਦਿਆਂ ਬਹੁਤ ਹੀ ਸਮਾਂ ਲੱਗ ਜਾਂਦਾ ਹੈ ਤਾਂ ਉਸ ਤੋਂ ਵੱਡੀ ਰਸਤੇ ਵਿੱਚ ਆਉਣ ਦੀ ਰੁਕਾਵਟ ਇਹ ਹੈ ਕਿ ਰਸਤਾ ਬਹੁਤ ਹੀ ਜ਼ਿਆਦਾ ਖ਼ਰਾਬ ਹੈ ਐਬੂਲੈਂਸ ਵਾਸਤੇ ਸੜਕ ਸੜਕ ਬਹੁਤ ਹੀ ਜ਼ਿਆਦਾ ਖ਼ਰਾਬ ਹੈ ਜਿਸ ਕਾਰਨ ਐਬੂਲੈਂਸ ਨੂੰ ਸਾਡੇ ਪਿੰਡ ਵਿੱਚ ਆਉਣ ਵਾਸਤੇ ਬਹੁਤ ਹੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਇਸ ਦਿੱਕਤ ਦਾ ਸਾਡੇ ਪਿੰਡ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਦੋਂ ਤੱਕ ਐਬੂਲੈਂਸ ਸਾਡੇ ਪਿੰਡ ਵਿੱਚ ਆਉਂਦੀ ਹੈ ਤਾਂ ਮਰੀਜ਼ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਜਾਂਦੀ ਹੈ ਇਹ ਬਹੁਤ ਹੀ ਵੱਡੀ ਮੁਸ਼ਕਿਲ ਹੈ ਸਾਡੇ ਪਿੰਡ ਦੇ ਵਿੱਚ ਕੀ ਸਾਨੂੰ ਐਂਬੂਲੈਂਸ ਖ਼ਰਾਬ ਕਨੈਕਟੀਵਿਟੀ ਬਹੁਤ ਹੀ ਜ਼ਿਆਦਾ ਹੈ